ਅੱਜ ਕੱਲ ਵਧੇਰੇ ਗਾਇਕ ਮੰਡੀ ਦੇ ਪ੍ਰਭਾਵ ਅਧੀਨ ਗਾਉਂਦੇ ਹਨ ਵਧੇਰੇ ਗਾਇਕ ਪੈਸੇ ਅਤੇ ਆਪਣੀ ਪ੍ਰਸਿੱਧੀ ਲਈ ਗਾਉਂਦੇ ਹਨ ਜੋ ਕਿ ਆਪਣੇ ਗਾਣਿਆਂ ਵਿੱਚ ਲੱਚਰਤਾ ਅਤੇ ਨਸ਼ਿਆਂ ਨੂੰ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਦੇ ਹਨ ਸ ਉਹ ਕਲਾਕਾਰ ਸੱਭਿਆਚਾਰ ਦਾ ਧਿਆਨ ਨਹੀਂ ਰੱਖਦੇ ਉਹਨਾਂ ਦੇ ਗੀਤ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਨਹੀਂ ਹੁੰਦੇ ਉਹ ਆਪਣੇ ਸਮਾਜ ਨੂੰ ਕੋਈ ਸੇਧ ਨਹੀਂ ਦੇ ਰਹੇ ਗਾਇਕਾਂ ਨੂੰ ਆਪਣੇ ਸਮਾਜ ਨੂੰ ਸੇਧ ਦੇਣ ਲਈ ਗੋ ਗਾਣੇ ਗਾਉਣੇ ਚਾਹੀਦੇ ਹਨ ਗਾਇਕਾਂ ਨੂੰ ਆਪਣੇ ਸੱਭਿਆਚਾਰ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਗਾਇਕਾਂ ਵੱਲੋਂ ਗਾਏ ਗਏ ਗਾਣੇ ਸਮਾਜ ਅਤੇ ਨੌਜਵਾਨਾਂ ਨੂੰ ਇੱਕ ਐਸੀ ਸੇਧ ਦੇਣੀ ਚਾਹੀਦੀ ਹੈ ਜੋ ਕਿ ਨੌਜਵਾਨ ਸਮਾਜ ਵਿੱਚ ਕੁਝ ਕਰ ਸਕਣ ਅਤੇ ਆਪਣੇ ਨਾਮ ਨੂੰ ਰੋਸ਼ਨ ਕਰ ਸਕਣ ਨੌਜਵਾਨਾਂ ਵੱਲੋਂ ਗਾਣਿਆਂ ਦਾ ਵਧੇਰੇ ਪ੍ਰਭਾਵ ਲਿਆ ਜਾਂਦਾ ਹੈ ਨੌਜਵਾਨ ਗਾਣੇ ਸੁਣ ਕੇ ਹੀ ਆਪਣੇ ਜੀਵਨ ਵਿੱਚ ਵਾਪਰਨ ਕ ਅਤੇ ਕਰਨ ਵਾਲੀਆਂ ਘਟਨਾਵਾਂ ਨੂੰ ਵਧੇਰੇ ਪ੍ਰਭਾਵਿਤ ਹੁੰਦੇ ਹਨ ਨੌਜਵਾਨ ਗਾਣੇ ਸੁਣਦੇ ਹਨ ਅਤੇ ਉਹਨਾਂ ਗਾਣਿਆਂ ਰਾਹੀਂ ਆਪਣੇ ਜੀਵਨ ਵਿੱਚ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਵਿੱਚ ਹਥਿਆਰਾਂ ਰਾਹੀਂ ਕਰੀਆਂ ਹੋਈਆਂ ਘਟਨਾਵਾਂ ਵਧੇਰੇ ਗਾਣਿਆਂ ਦਾ ਪ੍ਰਭਾਵ ਹੀ ਸਾਨੂੰ ਵੇਖਣ ਨੂੰ ਮਿਲਦਾ ਹੈ